ਔਰਤਾਂ ਨੂੰ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਇਕੱਲੀ ਜਾਂਦੀ ਬੱਸ ਵਿੱਚ ਔਰਤ ਨੂੰ ਬਹੁਤ ਸਾਰੇ ਲੋਕ ਵੇਖਦੇ ਹਨ ਅਤੇ ਸੈਨਤਾਂ ਮਾਰਦੇ ਹਨ ਇਸੇ ਤਰ੍ਹਾਂ ਛੋਟੇ ਕੱਪੜੇ ਪਾਉਂਦੀ ਔਰਤ ਨੂੰ ਵੀ ਸਾਰੇ ਦੇਖਦੇ ਹਨ ਅਤੇ ਉਸ ਨੂੰ ਬਹੁਤ ਸਾਰੀਆਂ ਸੈਨਤਾਂ ਮਾਰਦੇ ਹਨ ਸਮਾਜ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ ਅਤੇ ਔਰਤ ਨੂੰ ਸਨਮਾਨ ਦਾ ਹਿੱਸਾ ਦੇਣਾ ਚਾਹੀਦਾ ਹੈ ਘਰ ਵਿੱਚ ਵੀ ਔਰਤ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਵਿੱਚ ਔਰਤ ਇਕੱਲੀ ਕੰਮ ਕਰਦੀ ਹੈ ਜੋ ਕਿ ਬਹੁਤ ਗਲਤ ਹੈ ਔਰਤ ਨੂੰ ਕੰਮ ਦੇ ਨਾਲ ਬਾਹਰ ਦਾ ਕੰਮ ਵੀ ਕਰਨਾ ਚਾਹੀਦਾ ਹੈ ਜਿਵੇਂ ਕਿ ਜੋਬ ਜੋਬ ਵੀ ਕਰਨੀ ਚਾਹੀਦੀ ਹੈ ਅਤੇ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਇਕੱਲੇ ਕਰਨਾ ਪੈਂਦਾ ਹੈ ਜਿਸ ਕਾਰਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਵੀ ਹੱਥ ਵਟਾਵੇ ਘਰ ਦਾ ਕੰਮ ਕਰਾਵੇ ਔਰਤ ਨਾਲ ਸਾਰੇ ਕੰਮ ਕਰਾਵੇ ਤਾਂ ਜੋ ਔਰਤ ਨੂੰ ਸਮਾਨ ਹਿੱਸਾ ਮਿਲੇ ਧੰਨਵਾਦ